ਰੋਪੜ ਜਿਲ੍ਹੇ ਵਿੱਚ ਬਹੁਤ ਸਾਰੇ ਕਿੱਤੇ ਹਨ ਜਿਨ੍ਹਾਂ ਵਿੱਚੋਂ ਕਣਕ ਚੋਲ ਆਲੂ ਪਿਆਜ ਮੱਕੀ ਦਾਲ਼ਾਂ ਆਦਿ ਆਉਂਦੇ ਹਨ ਇਸ ਤੋਂ ਇਲਾਵਾ ਸਬਜ਼ੀਆਂ ਔਰ ਪਸ਼ੂ ਮੱਝਾਂ ਗਾਵਾਂ ਬੱਕਰੀਆਂ ਜਿਨ੍ਹਾਂ ਸਾਰਿਆਂ ਤੋਂ ਸਾਨੂੰ ਧਨ ਦੁੱਧ ਮਿਲਦਾ ਹੈ ਦੁੱਧ ਤੋਂ ਅਸੀਂ ਮੱਖਣ ਦਹੀ ਲੱਸੀ ਪਨੀਰ ਕਰੀਮ ਆਦਿ ਤਿਆਰ ਕਰਦੇ ਹਾਂ ਇਹਨਾਂ ਸਾਰਿਆਂ ਤੋਂ ਅਸੀਂ ਆਮਦਨ ਕਮਾਂ ਸਕਦੇ ਹਾਂ